ਨਹੀਂ ਮੇਰੇ ਘਰ ਦੇ ਨੇੜੇ ਕੋਈ ਕਲਾ ਸਪਲਾਈ ਸਟੋਰ ਨਹੀਂ ਹੈ ਮੈਂ ਨਿਮਿਤ ਤੌਰ 'ਤੇ ਸਟੂਡੈਂਟ ਕੌਰਨਰ ਤੋਂ ਸਟੇਸ਼ਨਰੀ ਦੀਆਂ ਚੀਜ਼ਾਂ ਖਰੀਦਦੀ ਹਾਂ ਹਾਂ ਮੈਂ ਕਲਾ ਅਤੇ ਸ਼ਿਲਪਕਾਰੀ ਵਿੱਚ ਹਾਂ ਮੈਨੂੰ ਕਲਾ ਦੀ ਸਾਰੀ ਸਮੱਗਰੀ ਬਹੁਤ ਪਸੰਦ ਹੈ ਇਹਨਾਂ ਵਿੱਚ ਮੈਨੂੰ ਰੰਗ ਅਤੇ ਰੰਗਾਂ ਵਿੱਚ ਮੈਨੂੰ ਪੈਂਸਿਲ ਰੰਗ ਕਰਿਓਨ ਰੰਗ ਡੱਬੀ ਵਾਲੇ ਰੰਗ ਬਹੁਤ ਚੰਗੇ ਲੱਗਦੇ ਹਨ ਮੈਨੂੰ ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਕਾਗਜ਼ ਚੰਗੇ ਲੱਗਦੇ ਹਨ